ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਂ ਜਲੰਧਰ ਤੋਂ ਬੋਲ ਰਹੀ ਸੀ ਅਤੇ ਤੁਸੀਂ ਗੁਰਦੁਆਰੇ ਸਾਹਿਬ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਹੋ ਐਕਚੁਲੀ ਮੈਂ ਤੁਹਾਡਾ ਨੰਬਰ ਇੰਟਰਨੈੱਟ ਤੋਂ ਲਿਆ ਸੀ ਐਕਚੁਲੀ ਮੈਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਵਲੋਗ ਬਣਾ ਰਹੀ ਸੀ ਵੀ ਤੁਸੀਂ ਮੈਨੂੰ ਥੋੜ੍ਹਾ ਬਹੁਤ ਉਹਨਾਂ ਬਾਰੇ ਦ ਦੱਸੂੰਗੇ ਮੇਰੀ ਥੋੜ੍ਹੀ ਹੈਲਪ ਹੋ ਜਾਵੇਗੀ ਉਹਨਾਂ ਬਾਰੇ ਮਤਲਬ ਜੋ ਉਹਨਾਂ ਦੀ ਸ਼ਹੀਦੀ ਵਗੈਰਾ ਹੋਈ ਅਤੇ ਉਹਨਾਂ ਦਾ ਮਤਲਬ ਵੀ ਇਤਿਹਾਸ ਕਿਆ ਸੀ ਹਾਂਜੀ ਉਮਰ ਬਾਰੇ ਤਾਂ ਮਤਲਬ ਵੀ ਪਤਾ ਹੈ ਉਸ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਦੱਸ ਹਾਂਜੀ ਹਾਂਜੀ ਹਾਂਜੀ ਅਤੇ ਜੋਤੀ ਸਰੂਪ ਗੁਰਦੁਆਰੇ ਵੀ ਹੈ ਇੱਕ ਉਹਨਾਂ ਦਾ ਇਤਿਹਾਸ ਹਾਂਜੀ ਹਾਂਜੀ ਮੈਮ ਅਤੇ ਹੋਰ ਵੀ ਥੋੜ੍ਹਾ ਬਹੁਤ ਦੱਸੋਗੇ ਵੀ ਜੀ ਇੱਕ ਭੋਰਾ ਸਾਹਿਬ ਗੁਰਦੁਆਰਾ ਸੀ ਇੱਕ ਭੋਰਾ ਸਾਹਿਬ ਵੀ ਜਗ੍ਹਾ ਸੀ ਅੱਛਾ ਹਾਂਜੀ ਮੈਮ

ਹਾਂਜੀ ਹਾਂਜੀ ਮੈਮ ਹੋਰ ਇੱਕ ਮਤਲਬ ਜੋ ਸਭਾ ਕਹਿੰਦੇ ਹੈ ਵੀ ਦਸੰਬਰ ਦੇ ਮਹੀਨੇ 'ਚ ਹੁੰਦੀ ਹੈ ਹਾਂਜੀ ਹਾਂਜੀ ਵੈਸੇ ਬਹੁਤ ਕੁਛ ਮਤਲਬ ਵਲੋਗ ਦੇ ਵਿੱਚ ਕਵਰ ਹੋ ਗਿਆ ਹਾਂਜੀ ਮੈਂ ਜ਼ਰੂਰ ਆਊਂਗੀ ਥੈਂਕ ਯੂ ਤੁਹਾਡੀ ਬਹੁਤ ਬਹੁਤ ਤੁਸੀਂ ਮੇਰੀ ਹੈਲਪ ਕਰੀ ਹਾਂਜੀ